ਹਾਂ ਨੂੰ ਆਪਾਂ ਨੂੰ ਸਾਈਕਲ ਚਲਾਉਣ ਲੱਗਿਆ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਵਾ ਕਿਉਂਕਿ ਜਿਹੜੀ ਸਾਈਕਲ ਹੁੰਦੀ ਆ ਉਹ ਵੀ ਇੱਕ ਪ੍ਰਕਾਰ ਦੀ ਮੋਟਰਸਾਈਕਲ ਵਰਗੀ ਹੁੰਦੀ ਕਿਉਂਕਿ ਮੋਟਰਸਾਈਕਲ ਦਾ ਜਿੱਦਾਂ ਇੰਜਨ ਖਲੋ ਜਾਂਦਾ ਪਰ ਜਿਹੜੀ ਸਾਈਕਲ ਆ ਉਹਦੀ ਚੈਨ ਉਤਰ ਜਾਂਦੀ ਟਾਇਰ ਪੈਂਚਰ ਹੋ ਜਾਂਦਾ ਜਾਂ ਕਿਤੇ ਆਪਾਂ ਨੂੰ ਜਗ੍ਹਾ ਦੇਖ ਕੇ ਤੁਰਨਾ ਚਾਹੀਦਾ ਵਾ ਕਿੱਦਾਂ ਹੁਣ ਧੁੰਦ ਪੈਣਦੀ ਆ ਧੁੰਦ ਦੇ ਕਾਰਨ ਧੁੰਦ ਦੇ ਕਾਰਨ ਆਪਣਾ ਕੀ ਨਾਮ ਹੁੰਦਾ ਵਾ ਧੁੰਦ ਦੇ ਕਾਰਨ ਆਪਣੀ ਕਿਹੜਾ ਵਾ ਕਿ ਰਾਤ ਪਤਾ ਨਹੀਂ ਲੱਗਦਾ ਕਿ ਆਪਾਂ ਨੂੰ ਹੌਲੀ ਹੌਲੀ ਸਾਈਡ 'ਤੇ ਜਾਣਾ ਚਾਹੀਦਾ ਵਾ ਆਪਣੇ ਕੋਲ ਸਾਇਕਲ ਦੀ ਸੁਰੱਖਿਆ ਰੱਖਿਆ ਲਈ ਆਪਾਂ ਨੂੰ ਪੰਪ ਰੱਖਣਾ ਚਾਹੀਦਾ ਵਾ ਨਾਲ ਜਿੱਦਾਂ ਚੈਨ ਢਿੱਲੀ ਹੋ ਜਾਂਦੀ ਪੇਜਕਸ ਹੋ ਗਿਆ ਜਾਂ ਕੋਈ ਹੋਰ ਟੂਲ ਹੋ ਗਿਆ ਰੱਖਣਾ ਚਾਹੀਦਾ ਅਤੇ ਆਪਣੀ ਕਿਹੜੇ ਸਾਈਕਲ ਆ ਉਹਨੂੰ ਆਪਾਂ ਨੂੰ ਤੇਜ ਵੀ ਚਲਾਉਣੀ ਆ ਉਹ ਵੀ ਪਰ ਸਾਈਡ 'ਤੇ ਚਲਾਉਣੀ ਚਾਹੀਦੀ ਆ ਮੈਨੂੰ ਅੱਜ ਵੀ ਯਾਦ ਆ ਇੱਕ ਵਾਰੀ ਮੈਂ ਗਿਆ ਹਾਂ ਕਿਤੇ ਅਤੇ ਰਾਹ 'ਚ ਟਾਇਰ ਪੈਂਚਰ ਹੋ ਗਿਆ ਨਾ ਉੱਥੇ ਲਾਗੇ ਬੰਨੇ ਕੋਈ ਦੁਕਾਨ ਹੈਗੀ ਸੀ ਅਤੇ ਉੱਤੋਂ ਬਹੁਤ ਬਾਰਿਸ਼ ਵੀ ਬੜੀ ਹੁੰਦੀ ਹੀ ਅਤੇ ਮੇਰੇ ਜਿਹੜੇ ਆਪਣੇ ਹੁੰਦੇ ਆ ਕਿ ਮੈਂ ਬਹੁਤ ਦੂਰ ਤੱਕ ਤੁਰ ਕੇ ਗਿਆ ਅਤੇ ਆਪਾਂ ਨੂੰ ਕਿਹੜਾ ਹੁੰਦਾ ਵਾ ਕਿ ਵੱਧ ਤੋਂ ਵੱਧ ਸਾਈਕਲ ਨਾਲ ਸੈਰ ਕਰਨੀ ਹੀ ਅਤੇ ਪਰ ਆ ਕੇ ਮੈਨੂੰ ਅੱਧੇ ਰਾਹ 'ਚੋ ਮੁੜਨਾ ਪਿਆ ਕਿਉਂਕਿ ਉੱਥੇ ਅੱਗੇ ਜਾ ਕੇ ਵੀ ਕੋਈ ਦੁਕਾਨ ਨਹੀਂ ਹੈਗੀ ਹੀ ਫਿਰ ਮੈਨੂੰ ਵਾਪਸ ਆਉਣਾ ਪਿਆ ਉੱਥੋਂ ਪੈਂਚਰ ਲਵਾਇਆ ਉਹ ਵੀ ਮੈਂ ਘਰੋਂ ਆਪਣੀ ਥੋੜ੍ਹਾ ਧਿਆਨ 'ਚ ਰੱਖ ਕੇ ਜਾਂਦਾ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਸਾਈਕਲ ਚਲਾਉਣ 'ਚ ਆਸਾਨੀ ਹੋਣੀ ਹੀ ਜਿਹੜੀ ਸਾਈਕਲ ਆ ਉਹ ਆਪਾਂ ਨੂੰ ਚਲਾਉਣੀ ਚਾਹੀਦੀ ਹੈ ਅਤੇ ਆਪਣੇ ਕਿਹੜੇ ਹੁੰਦੇ ਆ